ਭੰਗੜਾ ਪੰਜਾਬੀ ਵਿਰਾਸਤ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਭੰਗੜਾ ਚਾਰ ਪੰਜ ਗੱਭਰੂ ਨੌਜਵਾਨ ਇਕੱਠੇ ਹੋ ਕੇ ਖੁਸ਼ੀ ਦੇ ਮੌਕੇ ਪਾਉਂਦੇ ਹਨ ਭੰਗੜਾ ਹਰ ਇੱਕ ਖੁਸ਼ੀ ਨੂੰ ਉਜਾਗਰ ਕਰਨ ਲਈ ਕੀਤਾ ਜਾਂਦਾ ਹੈ ਭੰਗੜੇ ਦੇ ਕੁਛ ਖ਼ਾਸ ਸਟੈਪ ਹਨ ਜਿਵੇਂ ਭਲਵਾਨੀ ਚਾਲ ਝੂਮਰ ਲੁੱਡੀ ਗਿੱਧਾ ਜੂਲੀ ਦਾਨਕਾਰਾ ਧਮਾਲ ਸਾਮੀ ਕਿੱਕਲੀ ਅਤੇ ਗੱਤਕਾ ਇਹ ਸਭ ਭੰਗੜੇ ਦੇ ਖਾਸ ਸਟੈਪ ਮੰਨੇ ਜਾਂਦੇ ਹਨ ਅਤੇ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮਾਂ 'ਤੇ ਭੰਗੜਾ ਪਾਉਣਾ ਖ਼ਾਸ ਗੱਲ ਹੈ ਅਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਹਰ ਇੱਕ ਕਾਲਜ ਹਰ ਇੱਕ ਯੂਨੀਵਰਸਿਟੀਆਂ ਦੇ ਵਿੱਚ ਕਾਫ਼ੀ ਗਰੁੱਪ ਇਕੱਠੇ ਹੋ ਕੇ ਪਾਰਟੀਸਪੇਟ ਕਰਦੇ ਹਨ ਅਤੇ ਆਪਣਾ ਮਿਹਨਤ ਕਰਕੇ ਕਾਫ਼ੀ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਂਦੇ ਹਨ ਭੰਗੜਾ ਪਾਉਂਦੇ ਸਮੇਂ ਆਪਣੇ ਵੱਲੋਂ ਮਨੋ ਤਨੋ ਮਿਹਨਤ ਨਾਲ ਅਤੇ ਭੰਗੜਾ ਪਾਉਂਦੇ ਹਨ ਅਤੇ ਭੰਗੜਾ ਪਾਉਂਦੇ ਸਮੇਂ ਆਪਣੇ ਦਿਲ ਦੀ ਖੁਸ਼ੀ ਉਜਾਗਰ ਹੁੰਦੀ ਹੈ ਅਤੇ ਭੰਗੜਾ ਪਾਉਂਣ ਨਾਲ ਕੁੜਤੇ ਚਾਦਰੇ ਵੀ ਲੱਗੇ ਹੁੰਦੇ ਹਨ ਅਤੇ ਖ਼ਾਸ ਪਹਿਰਾਵਾ ਪਾਇਆ ਹੋਣ ਦੇ ਬਾ ਕਾਰਣ ਦਰਸ਼ਕਾਂ ਦੇ ਦਿਲਾਂ ਨੂੰ ਖਿੱਚਦਾ ਹੈ ਅਤੇ ਭੰਗੜੇ ਦੇ ਸਟੈਪ ਇੱਦਾਂ ਦੇ ਹੁੰਦੇ ਹਨ ਕਿ ਬੰਦੇ ਨੂੰ ਜਿਹੜੇ ਦਰਸ਼ਕ ਇਕੱਠੇ ਹੁੰਦੇ ਹਨ ਉਹਨਾਂ ਨੂੰ ਵੀ ਨੱਚਣ 'ਤੇ ਮਜ਼ਬੂਰ ਕਰ ਦਿੰਦੇ ਹਨ ਅਤੇ ਦਰਸ਼ਕਾਂ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਭੰਗੜਾ ਦੇਖਦੇ ਜਾਂ ਪਾਉਂਦੇ ਸਮੇਂ ਵੀ ਅਤੇ ਜੱਜਾਂ ਨੂੰ ਆਪਣੇ ਪਾਰਟੀਸਪੇਟ ਕੀਤੀਆਂ ਟੀਮਾਂ ਦੇ ਵਿੱਚੋਂ ਸ ਇੱਕ ਬੰ ਨੂੰ ਟੀਮ ਨੂੰ ਸਲੈਕਟ ਕਰਨਾ ਦੇ ਵਿੱਚ ਕਾਫ਼ੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਸਾਰੀਆਂ ਟੀਮਾਂ ਆਪਣੇ ਵੱਲੋਂ ਮਨੋ ਤਨੋ ਮਿਹਨਤ ਨਾਲ ਭੰਗੜਾ ਪਾਉਂਦੇ ਹਨ ਭੰਗੜਾ ਇਸ ਕਰਕੇ ਪੰਜਾਬ ਦੀ ਖ਼ਾਸ ਵਿਰਾਸਤ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ